ਹਾਂ ਮੈਂ ਕੁਕਿੰਗ ਕਲਾਸਾਂ ਵਿੱਚ ਭਾਗ ਲਿਆ ਹੈ ਪਹਿਲਾਂ ਮੈਂ ਘਰ ਦਾ ਹੀ ਖਾਣਾ ਬਣਾਉਂਦੀ ਸੀ ਛੇ ਮਹੀਨੇ ਪਹਿਲਾਂ ਮੈਂ ਕੁਕਿੰਗ ਕਲਾਸਾਂ ਚਾਲੂ ਕੀਤੀਆਂ ਨੇ ਆਪਣੇ ਪਿੰਡ ਦੇ ਵਿੱਚ ਕਲਾਸਾਂ ਲੱਗਣੀਆਂ ਸ਼ੁਰੂ ਹੋਈਆਂ ਸੀ ਮੈਂ ਭਾਗ ਲਿਆ ਉੱਥੇ ਮੈਂ ਬਹੁਤ ਕੁਝ ਸਿੱਖਿਆ ਜਿਵੇਂ ਕਿ ਨਿਊਡਲ ਬਰਗਰ ਮਲਾਈ ਚਾਪਾਂ ਸਪਰਿੰਗ ਰੋਲ ਮਸਾਲੇਦਾਰ ਮੈਗੀ ਡੋਕਲਾ ਡੋਸਾ ਇਡਲੀ ਬਹੁਤ ਕੁਝ ਸਿੱਖਿਆ ਹੁਣ ਮੈਂ ਜਦੋਂ ਵੀ ਉਹ ਚੀਜ਼ਾਂ ਘਰ ਵਿੱਚ ਬਣਾਉਂਦੀ ਹਾਂ ਮੇਰੇ ਪਰਿਵਾਰ ਨੂੰ ਉਹ ਚੀਜ਼ਾਂ ਬਹੁਤ ਸੁਆਦ ਲੱਗਦੀਆਂ ਨੇ ਉਹ ਮੇਰੀ ਬਹੁਤ ਤਾਰੀਫਾਂ ਕਰਦੇ ਨੇ ਮੈਨੂੰ ਆਪਣੇ ਆਪ ਨੂੰ ਵੀ ਬਹੁਤ ਚੰਗਾ ਲੱਗਦਾ ਹੈ ਘਰ ਵਿੱਚ ਜਦੋਂ ਵੀ ਪ੍ਰਹੁਣੇ ਆਉਂਦੇ ਨੇ ਅਤੇ ਮੈਂ ਉਹਨਾਂ ਨੂੰ ਚਾਹ ਨਾਲ ਇਹ ਚੀਜ਼ਾਂ ਬਣਾ ਕੇ ਦਿੰਦੀ ਹਾਂ ਮੇਰੇ ਬੱਚੇ ਮੈਗੀ ਮਸਾਲਾ ਬੜੇ ਚਾਉ ਨਾਲ ਖਾਂਦੇ ਹਨ ਮੈਂ ਕੁਕਿੰਗ ਕਲਾਸਾਂ ਵਿੱਚ ਬਹੁਤ ਕੁਝ ਸਿੱਖਿਆ ਮੈਂ ਪਹਿਲਾਂ ਸਿੰਪਲ ਖਾਣਾ ਬਣਾਉਂਦੀ ਸੀ ਪਰ ਹੁਣ ਮੈਨੂੰ ਹਰ ਤਰ੍ਹਾਂ ਦਾ ਖਾਣਾ ਬਣਾਉਣਾ ਆਉਂਦਾ ਹੈ ਮੈਂ ਸਭ ਕੁਝ ਬਣਾ ਲੈਂਦੀ ਹਾਂ ਕੁਕਿੰਗ ਕਲਾਸਾਂ ਵਿੱਚ ਮੈਨੂੰ ਬਹੁਤ ਫਾਇਦਾ ਹੋਇਆ ਮੈਂ ਬਹੁਤ ਖੁਸ਼ ਹਾਂ